ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਗੇ ਨਾ ਲੋਕ ਨਾਚਾਂ ਵਿੱਚੋਂ ਇੱਕ ਹੈ ਦੂਜਾ ਮੁੱਖ ਨਾਚ ਭੰਗੜਾ ਗੱਭਰੂਆਂ ਦਾ ਨਾਚ ਜਦਕਿ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ ਤੇ ਪਾਇਆ ਅਤੇ ਨੱਚਿਆ ਜਾਂਦਾ ਹੈ ਜਿਨਾਂ ਵਿਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ ਵੇਲੇ ਵੀ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਇਹ ਆਮ ਤੌਰ ਤੇ ਹਰੇਕ ਖੁਸ਼ੀ ਦੇ ਮਾਹੌਲ ਵਿਚ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਪੰਜਾਬੀਆਂ ਦੀ ਸ਼ਾਨ ਹ ਭੰਗੜਾ ਪਾਉਣ ਵੇਲੇ ਕਲਾਕਾਰ ਦੇ ਤੁਰਲੇ ਵਾਲੀ ਪੱਗ ਜਿਸ ਉਪਰ ਗੋਟਾ ਲੱਗਿਆ ਹੁੰਦਾ ਹੈ ਬੰਨੀ ਹੁੰਦੀ ਹੈ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਜਿਸ ਉਪਰ ਗੋਟਾ ਲੱਗਿਆ ਹੁੰਦਾ ਹੈ ਉਸ ਉਸਦੇ ਲੰਬਾ ਕੁੜਤਾ ਖੁੱਲਾ ਚਾਦਰਾ ਅਤੇ ਪੈਰਾਂ ਵਿੱਚ ਤਿੱਲੇਦਾਰ ਜੁੱਤੀ ਪਾਈ ਜਾਂਦੀ ਹੈ ਗਲ ਵਿੱਚ ਕੈਂਠਾ ਪਾਇਆ ਜਾਂਦਾ ਹੈ ਕੁੜਤੇ ਉੱਪਰ ਜਾਕਿਟ ਹੋਰ ਵੀ ਸੁੰਦਰ ਲੱਗਦੀ ਹੈ ਇਹ ਪਹਿਰਾਵਾ ਹਰੇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਗੂੜੇ ਕੱਪੜੇ ਉੱਚੀ ਪੱਗ ਸੋਹਣੇ ਕੈਂਠੇ ਹਰੇਕ ਦਾ ਧਿਆਨ ਖਿੱਚਦੇ ਹਨ ਅਤੇ ਭੰਗੜਾ ਪਾਉਣ ਵਾਲਾ ਦੂਰ ਤੱਕ ਧਿਆਨ ਖਿੱਚ ਕੇ ਲੋਕਾਂ ਵਿੱਚ ਵਾਹ ਵਾਹ ਖਟਦਾ ਹੈ ਇਸ ਪਹਿਰਾਵੇ ਨਾਲ ਉਸਨੂੰ ਵੱਖਰੀ ਦਿੱਖ ਮਿਲਦੀ ਹੈ ਜੋ ਉਸਨੂੰ ਹੋਰ ਆਕਰਸ਼ਿਤ ਬਣਾਉਂਦੀ ਹੈ ਭੰਗੜਾ ਹਰੇਕ ਖੁਸ਼ੀ ਦੇ ਮੌਕੇ ਤੇ ਪਾਇਆ ਜਾਂਦਾ ਹੈ ਅੱਜ ਕੱਲ ਸਕੂਲਾਂ ਕਾਲਜਾਂ ਵਿੱਚ ਵੀ ਭੰਗੜਾ ਆਮ ਤੌਰ ਤੇ ਪਾਇਆ ਜਾਂਦਾ ਹੈ ਭੰਗੜਾ ਪਾਉਂਦੇ ਸਮੇਂ ਜੋ ਵੀ ਵਿਅਕਤੀ ਭੰਗੜਾ ਪਾਉਂਦਾ ਹੈ ਉਸਦੀਆਂ ਉਸਦੀਆਂ ਭਾਵਨਾਵਾਂ ਵੀ ਜਾਹਰ ਹੁੰਦੀਆਂ ਹਨ